ਬਰਤਨ ਧੋਣ ਲਈ ਬਹੁਤ ਹੀ ਆਸਾਨ ਪ੍ਰਕਿਰਿਆ ਅਗਰ ਜਿੱਦਾਂ ਕਿ ਕੋਈ ਤੇਲ ਵਾਲਾ ਬਰਤਣ ਧੋਣਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਉਸ ਬਰਤਨ ਨੂੰ ਇੱਕ ਵਾਰੀ ਪਾਣੀ 'ਚੋਂ ਸਾਫ ਕਰਕੇ ਰੱਖ ਸਕਦੇ ਹਾਂ ਫਿਰ ਉਸਦੇ ਵਿੱਚ ਸਾਬਣ ਲਗਾਉਂਦੇ ਹਾਂ ਜਿਸ ਦੇ ਨਾਲ ਕਿ ਜੋ ਵੀ ਉਸ 'ਤੇ ਕੋਈ ਚਿਕਨਾਈ ਹੁੰਦੀ ਹੈ ਤੇਲ ਮਤਲਬ ਕੁਛ ਵੀ ਹੁੰਦਾ ਤਾਂ ਉਹ ਉੱਤਰ ਜਾਂਦਾ ਕਿਉਂਕਿ ਸਾਬਣ ਨਾਲ ਉੱਤਰ ਹੀ ਜਾਂਦਾ ਓਵੀਸਲੀ ਅਤੇ ਫਿਰ ਉਸ ਤੋਂ ਬਾਅਦ ਅਸੀਂ ਕਿਸੇ ਵੀ ਕਿਸੀ ਵੀ ਚੀਜ਼ ਨਾਲ ਉਸਨੂੰ ਅੱਛੀ ਤਰ੍ਹਾਂ ਰਗੜ ਕੇ ਸਾਫ ਕਰ ਸਕਦੇ ਹਾਂ ਫਿਰ ਉਹ ਅੱਛੀ ਤਰ੍ਹਾਂ ਕੋਈ ਵੀ ਅਗਰ ਦਾਗ ਧੱਬਾ ਕੁਛ ਵੀ ਹੋਊਗਾ ਉਹ ਅੱਛੀ ਤਰ੍ਹਾਂ ਸਾਫ ਹੋ ਜਾਂਦਾ ਫਿਰ ਉਸਨੂੰ ਪਾਣੀ ਨਾਲ ਸਾਫ ਕਰਾਂਗੇ ਫਿਰ ਬਿਲਕੁਲ ਕਲੀਨ ਹੋ ਜੂਗਾ ਅਸੀਂ ਤੇਲ ਵਾਲੇ ਭਾਂਡੇ ਨੂੰ ਧੋਣ ਲਈ ਸਾਬਣ ਦੀ ਵਰਤੋਂ ਕਰਦੇ ਹਾਂ ਵਿੰਮ ਸਾਬਣ ਦੀ ਵਰਤੋਂ ਕਰਦੇ ਹਾਂ ਅਤੇ ਬਸ ਉਸ ਤੋਂ ਬਾਅਦ ਅਸੀਂ ਉਸ ਨੂੰ ਸੁਕਾ ਸਕਦੇ ਹਾਂ